ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਮਤਲਬ ਖਾਣ ਵਾਲੀਆਂ ਮਤਲਬ ਬਹੁਤ ਜ਼ਿਆਦਾ ਫੇਮਸ ਆ ਜਿੱਦਾਂ ਕਿ ਜੇ ਅਸੀਂ ਸਟਰੀਟ ਫ ਫੂਡ ਦੀ ਗੱਲ ਕਰੀਏ ਨਾ ਤਾਂ ਜਦੋਂ ਗੌਰਮੈਂਟ ਕੋਲਜ ਦੇ ਨਾਲ ਹੀ ਇੱਕ ਕੁਲਚਿਆਂ ਦੀ ਸ਼ੋਪ ਆ ਮਤਲਬ ਉਹ ਉੱਥੇ ਜਿਹੜੇ ਕੁਲਚੇ ਆ ਉਹ ਬਹੁਤ ਜ਼ਿਆਦਾ ਮਸ਼ਹੂਰ ਆ ਇਸ ਤੋਂ ਇਲਾਵਾ ਜਿਹੜੀ ਉਹ ਬੱਸ ਸਟੈਂਡ ਦੇ ਨਾਲ ਗਲੀ ਜਾਂਦੀ ਹੈ ਜਿਹੜੀ ਪੀਰ ਮੱਧੀ ਸ਼ਾਹ ਦੀ ਗਲੀ ਹੈ ਨਾ ਉਹ ਮਤਲਬ ਇੰਨੀ ਜ਼ਿਆਦਾ ਫੇਮਸ ਆ ਉੱਥੇ ਦੋ ਤਿੰਨ ਮੂਹਰੇ ਜਿੱਦਾਂ ਦੁਕਾਨਾਂ ਆ ਜਿੱਦਾਂ ਰੈਸਟੋਰੈਂਟ ਤੁਹਾਡਾ ਢਾਬਾ ਟਾਈਪ ਜਿਹਨੂੰ ਬੋਲਦੇ ਆ ਉੱਥੇ ਦੇ ਜਿਹੜੇ ਆ ਛੋਲੇ ਭਟੂਰੇ ਉਹ ਜਿੱਦਾਂ ਟਿੱਕੀਆਂ ਸਮੋਸੇ ਉਹ ਬਹੁਤ ਜ਼ਿਆਦਾ ਫੇਮਸ ਆ ਹਾਂਜੀ ਇਸ ਤੋਂ ਇਲਾਵਾ ਜੇ ਤੁਸੀਂ ਜੰਕ ਫੂਡ ਦੀ ਗੱਲ ਕਰਦੇ ਆਂ ਤਾਂ ਉਹ ਵੀ ਬਹੁਤ ਜ਼ਿਆਦਾ ਹੁਸ਼ਿਆਰਪੁਰ 'ਚ ਹੈਗੇ ਆ ਜਿੱਦਾਂ ਕਿ ਗੌਰਮੈਂਟ ਕੋਲਜ ਦੇ ਨਾਲ ਹੀ ਇੱਕ ਮਤਲਬ ਫਰੰਟ ਸਾਈ ਸਾਈਡ 'ਤੇ ਇੱਕ ਸ਼ੋਪ ਪੈਂਦੀ ਆ ਜਿੱਦਾਂ ਰਾਜ ਵਾਲਿਆਂ ਦੀ ਤਾਂ ਉੱਥੋਂ ਦੇ ਨਿਊਡਲਸ ਬਰਗਰ ਜਿਹੜੇ ਆ ਉਹ ਬਹੁਤ ਜ਼ਿਆਦਾ ਫੇਮਸ ਆ ਉਸ ਤੋਂ ਬਾਅਦ ਇੱਦਾਂ ਹੀ ਫਿਰ ਬੱਸ ਸਟੈਂਡ ਦੇ ਨੀਅਰ ਇੱਕ ਸ਼ੋਪ ਆ ਉੱਥੇ ਵੀ ਜਿੱਦਾਂ ਮਤਲਬ ਹੋ ਗਏ ਤਿੰਨ ਚਾਰ ਸਾਲ ਉਹਨੂੰ ਓਪਨ ਹੋਏ ਨੂੰ ਹੋ ਗਏ ਆ ਉੱਥੇ ਦਾ ਵੀ ਜਿਹੜੇ ਪੀਜ਼ਾ ਜਾਂ ਬਰਗਰ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਆ ਐਂਡ ਜੇ ਤੁਸੀਂ ਪੀਜ਼ੇ ਦੀ ਗੱਲ ਕਰਦੇ ਆ ਤਾਂ ਜਿਹੜਾ ਡੋਮੀਨੋਜ ਦਾ ਪੀਜ਼ਾ ਆ ਉਹ ਉੱਥੇ ਇੱਕ ਸ਼ੌਪ ਆ ਡੋਮੀਨੋਜ਼ ਉਹ ਵੀ ਬਹੁਤ ਜ਼ਿਆਦਾ ਫੇਮਸ ਆ ਉੱਥੇ ਦਾ ਹਾਂਜੀ ਅਤੇ ਹਾਂਜੀ ਹੋਰ ਹਾਂਜੀ ਅਤੇ ਹਾਂਜੀ ਜੇ ਤੁਸੀਂ ਮਤਲਬ ਜੇ ਤੁਸੀਂ ਪੀਜੇ ਵਗੈਰਾ ਦੀ ਗੱਲ ਕਰਦੇ ਆ ਤਾਂ ਮੈਂ ਤੁਹਾਨੂੰ ਸੂਜੈਸਟ ਕਰੂੰਗੀ ਡੋਮੀਨੋਜ ਤੋਂ ਬੈਟਰ ਕੋਈ ਆਪਸ਼ਨ ਹੋ ਨਹੀਂ ਸਕਦੀ ਐਂਡ ਜੇ ਤੁਸੀਂ ਇਹ ਚਾਹੁੰਦੇ ਆ ਵੀ ਤੁਸੀਂ ਰੀਜਨਏਬਲ ਵੀ ਤੁਹਾਨੂੰ ਚਾਹੀਦਾ ਆ ਅਤੇ ਹੈਲਦੀ ਵੀ ਚਾਹੀਦਾ ਆ ਤਾਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬੱਸ ਸਟੈਂਡ ਦੇ ਨੀਅਰ ਜਿਹੜੀਆਂ ਦੋ ਤਿੰਨ ਸ਼ੌਪ ਆ ਜਿੱਥੇ ਛੋਲੇ ਭਟੂਰੇ ਸਮੋਸੇ ਅਤੇ ਇਹ ਇਹ ਵਾਲੇ ਫੂਡ ਮਿਲਦੇ ਆ ਉੱਥੇ ਫਸਟ ਤਿੰਨ ਦੁਕਾਨਾਂ ਹੈਗੀਆਂ ਲੈਫਟ ਸਾਈਡ 'ਤੇ ਤੇ ਉਹ ਮਤਲਬ ਬਹੁਤ ਜ਼ਿਆਦਾ ਵਧੀਆ ਆ ਹੈਲਦੀ ਵੀ ਆ ਖਾਣ ਦੇ ਲਈ ਇਹ ਸਾਫ ਸੁਥਰਾ ਵੀ ਹਾਈਜੀਨਿਕ ਦਾ ਵੀ ਧਿਆਨ ਰੱਖਿਆ ਜਾਂਦਾ ਕਿਉਂਕਿ ਤੁਹਾਨੂੰ ਵੀ ਇਸ ਗੱਲ ਦਾ ਪਤਾ ਵੀ ਜਿੱਥੇ ਹਾਈਜੀਨਿਕ ਹੋਵੇ ਉਹੀ ਚੀਜ਼ ਬੈਸਟ ਹੁੰਦੀ ਆ

ਹਾਂਜੀ ਹਾਂਜੀ ਹਾਂਜੀ ਮੈਂ ਵੀ ਸੁਣਿਆ ਸ ਸੁਣਿਆ ਅਤੇ ਵੈਸੇ ਆਪਣੀ ਫਰੈਂਡ ਤੋਂ ਹੀ ਸੁਣਿਆ ਸੀਗਾ ਹਾਂਜੀ ਉਹ ਅੱਛਾ ਕੁਝ ਮਤਲਬ ਵਿੱਚੇ ਆ ਘੰਟਾ ਘਰ ਆ ਜਗ੍ਹਾ ਹਾਂਜੀ ਘੰਟਾ ਘਰ ਦੇ ਉੱਥੇ ਰਾਤ ਨੂੰ ਮਤਲਬ ਉਹ ਲੱਗਦੇ ਪਏ ਆ ਜਿੱਦਾਂ ਫੂਡ ਸਟ ਸਟਰੀਟ ਫੂਡ ਜਿਹੜਾ ਹੁੰਦਾ ਰਾਤ ਨੂੰ ਮਤਲਬ ਲੱਗਦਾ ਆ ਅਤੇ ਉੱਥੇ ਰਾਤ ਨੂੰ ਹੀ ਲੋਕ ਮਤਲਬ ਖਾਣ ਲਈ ਜਾਂਦੇ ਆ ਉਹ ਸ਼ਾਮ ਨੂੰ ਚਲ ਜਾਂਦੇ ਆ ਅਤੇ ਫਿਰ ਉਹ ਆਪਣਾ ਜਿਹੜਾ ਸ਼ਾਮ ਦਾ ਮੀਲ ਉੱਥੇ ਇੰਜੋਏ ਕਰਦੇ ਆ ਹਾਂਜੀ ਅਗਰ ਤੁਸੀਂ ਜਾਣਾ ਚਾਹੋਗੇ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਉੱਥੇ ਤੁਸੀਂ ਜਾ ਸਕਦੇ ਆ ਵੈਸੇ ਮੈਂ ਤਾਂ ਗ ਨਹੀਂ ਗਈ ਮੇਰੀ ਫਰੈਂਡ ਨ ਗਈ ਸੀਗੀ ਅਤੇ ਉਹਨੇ ਮੈਨੂੰ ਦੱਸਿਆ ਸੀਗਾ ਹਾਂਜੀ ਹਾਂਜੀ ਹਾਂਜੀ ਰੇਟ ਵਗੈਰਾ ਸਹੀ ਹੁੰਦਾ ਵਧੀਆ ਹੁੰਦਾ ਆ ਅਤੇ ਜੇ ਤੁਸੀਂ ਛੋਲੇ ਛੋਲੇ ਭਟੂਰੇ ਦੀ ਜਾਂ ਕੁਲਫੀਆਂ ਦੀ ਗੱਲ ਕਰੋਗੇ ਤਾਂ ਜਿਹੜਾ ਗੌਰਮੈਂਟ ਕੋਲਜ ਦੇ ਨਾਲ ਜਿਹੜੇ ਸਾਹਮਣੇ ਫਰੰਟ 'ਤੇ ਸ਼ੋਪ ਪੈਂਦੀ ਆ ਉੱਥੇ ਦੇ ਜਿਹੜੇ ਕੁਲਚੇ ਆ ਉਹ ਬਹੁਤ ਮਤਲਬ ਟੇਸਟੀ ਬਣਦੇ ਆ ਬਹੁਤ ਜ਼ਿਆਦਾ ਮਤਲਬ ਮਸ਼ਹੂਰ ਆ ਮਤਲਬ ਈਵਨ ਕਿ ਕੋਲਜ ਦੇ ਲੋਕ ਅਤੇ ਆਲੇ ਦੁਆਲੇ ਦੇ ਸਾਰੇ ਲੋਕ ਨਾ ਉੱਥੇ ਹੀ ਖਾਣ ਆਉਂਦੇ ਆ ਹਾਂਜੀ ਹਾਂਜੀ ਠੀਕ ਆ ਥੈਂਕ ਯੂ ਜੀ ਓਕੇ ਥੈਂਕ ਯੂ